ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਰੀਅਲ ਸਟੇਟ ਤੋਂ ਗੱਲ ਕਰ ਰਹੀ ਹਾਂ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਤੁਸੀਂ ਫਲੈਟ ਲੈਣਾ ਪਸੰਦ ਕਰੋਗੇ ਕਿ ਆਪਣੀ ਜ਼ਮੀਨ ਲੈਣਾ ਪਸੰਦ ਕਰੋਗੇ ਹਾਂਜੀ ਅਤੇ ਜੇ ਤੁਹਾਨੂੰ ਹਾਂਜੀ ਹਾਂਜੀ ਤੁਹਾਨੂੰ ਮੈਂ ਇੱਥੇ ਹੀ ਬਹੁਤ ਸਾਰੇ ਫਲੈਟ ਹੈਗੇ ਨੇ ਆਪਣੇ ਨੇੜੇ ਨੇੜੇ ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਥ੍ਰੀ ਬੈੱਡ ਰੂਮ ਸੈੱਟ ਟੂ ਬੈੱਡ ਰੂਮ ਸੈੱਟ ਬੈੱਡ ਰੂਮ ਸੈੱਟ ਆਰਾਮ ਨਾਲ ਮਿਲ ਜਾਣਗੇ ਬਹੁਤ ਵੱਡੇ ਵੱਡੇ ਖੁੱਲ੍ਹੇ ਲੀਵਿੰਗ ਰੂਮ ਅਤੇ ਨਾਲ ਤੁਹਾਨੂੰ ਅਟੈਚ ਬਾਥਰੂਮ ਵਧੀਆ ਅੱਜ ਕੱਲ੍ਹ ਦੇ ਆਧੁਨਿਕ ਰਸੋਈਆਂ ਵੀ ਮਿਲ ਜਾਣਗੀਆਂ ਹਰੇਕ ਦੇ ਵਿੱਚ ਪੂਰਾ ਵਧੀਆ ਕੰਕਰੀਟ ਅਤੇ ਵਧੀਆ ਲੋਕੇਸ਼ਨ ਉੱਤੇ ਬਣੇ ਹੋਏ ਨੇ ਸਾਰੇ ਤੁਸੀਂ ਵੇਖੋ ਜਿਹੜੇ ਘਰ ਨੇ ਹਾਰ ਹਰ ਤਰ੍ਹਾਂ ਦਾ ਤੁਹਾਨੂੰ ਕੁਛ ਵੀ ਨਵਾਂ ਖਰੀਦਣਾ ਨਹੀਂ ਪੈਣਾ ਹਰ ਤਰ੍ਹਾਂ ਦਾ ਫਰਨੀਚਰ ਤੁਹਾਨੂੰ ਇਹਦੇ ਵਿੱਚ ਅਵੇਲੇਬਲਨ ਹੋਏਗਾ ਘਰ ਦੇ ਵਿੱਚ ਸਾਰੇ ਦਾ ਸਾਰਾ ਸਮਾਨ ਬਹੁਤ ਹੀ ਵਧੀਆ ਲੱਕੜ ਦਾ ਸਾਗਵਾਨ ਅਤੇ ਟਾਹਲੀ ਦੀਆਂ ਲੱਕੜਾਂ ਦਾ ਬਣਿਆ ਹੋਇਆ ਜਿੰਨੇ ਵੀ ਅਸੀਂ ਨੇ ਨੇੜੇ ਨੇੜੇ ਆਪਣੇ ਫਲੈਟ ਬਣਾਉਂਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਏ ਹੋਏ ਨੇ ਅਸੀਂ ਪੂਰੀਆਂ ਰੀਝਾਂ ਲਾਉਨੇ ਆ ਜੀ ਆਪਣੇ ਕਸਟਮਰ ਨੂੰ ਪੂਰੀ ਤਸੱਲੀ ਦਿੰਦੇ ਹਾਂ ਵਧੀਆ ਕੰਕਰੀਟ ਦੇ ਨਾਲ ਨਾਲ ਤੁਸੀਂ ਦੇਖੋਗੇ ਕਿ ਇੰਨੀ ਵਧੀਆ ਲੋਕੇਸ਼ਨ ਹੈ ਹਰੇਕ ਤਰ੍ਹਾਂ ਦੀ ਤੁਹਾਨੂੰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਤੁਹਾਡੇ ਆਪਣੇ ਫਲੈਟ ਦੇ ਨੇੜੇ ਹੀ ਤੁਹਾਨੂੰ ਜਿੰਮ ਤੁਹਾਨੂੰ ਸਵਿਮਿੰਗ ਪੂਲ ਤੁਹਾਡੇ ਬੱਚਿਆਂ ਦੇ ਖੇਡਣ ਲਈ ਪੂਰਾ ਖੇਡ ਦਾ ਮੈਦਾਨ ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਨਾਲ ਨਾਲ ਮਿਲ ਜਾਣਗੀਆਂ ਸਾਡੇ ਹਾਂਜੀ ਦੋ ਫੁੱਟ ਦੀ ਬਾਲਕਨੀ ਹੈ ਜੀ ਦੋਨੋਂ ਸਾਈਡਾਂ 'ਤੇ ਤੁਹਾਨੂੰ ਮਿਲ ਜਾਏਗੀ ਕਾਰ ਖੜ੍ਹੀ ਲਈ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਜੀ ਪਾਰਕਿੰਗ ਤੁਹਾਡੀ ਤੂਸੀਂ ਗੱਡੀਆਂ ਦੀ ਨੀਚੇ ਹੀ ਬਣੀ ਹੋਈ ਹੈ ਤੁਹਾਡੇ ਫਲੈਟਾਂ ਦੇ ਨੀਚੇ ਹਰੇਕ ਦੀ ਆਪਣੀ ਜਿਹੜੀ ਜਗ੍ਹਾ ਹੈ ਉਹ ਪੂਰੀ ਦਿੱਤੀ ਹੋਈ ਹੈ ਜੀ ਦੋ ਦੋ ਗੱਡੀਆਂ ਦੀ ਹਰੇਕ ਲਈ ਹਾਂਜੀ ਹਾਂਜੀ ਤੁਸੀਂ ਪੂਰੇ ਆਰਾਮ ਦੇ ਨਾਲ ਤੁਹਾਡੀ ਤੁਸੀਂ ਘਰ ਦਾ ਦਰਵਾਜ਼ਾ ਖੋਲੋਗੇ ਤੁਹਾਡੇ ਸਾਹਮਣੇ ਘਰ ਦੇ ਦਰਵਾ ਦਰਵਾਜੇ ਦੇ ਅੱਗੇ ਬਹੁਤ ਵੱਡਾ ਪਾਰਕ ਹੈ ਸਾਈਡ ਦੇ ਉੱਤੇ ਤੁਹਾਨੂੰ ਸਭ ਸਾਰੀਆਂ ਹੀ ਸਹੂਲਤਾਂ ਮਿਲ ਜਾਣਗੀਆਂ ਇੱਥੋਂ ਤੱਕ ਕਿ ਤੁਹਾਨੂੰ ਬੱਸ ਸਟੈਂਡ ਵੀ ਜਿਹੜਾ ਏ ਉਹ ਬਿਲਕੁਲ ਇੱਕ ਕਿਲੋਮੀਟਰ ਦੇ ਵਿੱਚ ਇਸ ਮਿਲ ਜਾਏਗਾ ਬਸ ਜਿਹੜੀ ਤੁਸੀਂ ਰੇਲਵੇ ਸਟੇਸ਼ਨ ਕਹਿ ਰਹੇ ਹੋ ਉਹ ਤੁਹਾਨੂੰ ਦਸ ਕਿਲੋਮੀਟਰ ਦੇ ਏਰੀਏ ਦੇ ਵਿੱਚ ਤੁਹਾਨੂੰ ਈਵਨ ਏਅਰਪੋਰਟ ਵੀ ਮਿਲ ਜਾਏਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ